ਅੱਜ ਤਾਂ ਪੰਜਾਬ ਵਿੱਚ ਸਿੱਖਿਆ ਦੀ ਅਵਰਨਾ ਬਹੁਤ ਵੱਧ ਗਈ ਆ ਅੱਜ ਕੱਲ੍ਹ ਕਾਫੀ ਚੀਜ਼ਾਂ ਹੁੰਦੀਆਂ ਹਨ ਜਿਹਦੇ ਨਾਲ ਬੱਚਿਆਂ ਦਾ ਨੁਕਸਾਨ ਨਹੀਂ ਹੁੰਦਾ ਸਟੱਡੀ ਪੜ੍ਹਾਈ ਵਿੱਚ ਬੱਚੇ ਔਨਲਾਈਨ ਕਲਾਸਾਂ ਲਾ ਲੈਂਦੇ ਆ ਦੂਰ ਬੈਠੇ ਵੀ ਬੱਚੇ ਕੁਛ ਸਿੱਖ ਲੈਂਦੇ ਹਨ ਅੱਜ ਕੱਲ੍ਹ ਜਿੱਦਾਂ ਦੀ ਸਰਦੀਆਂ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਅਤੇ ਔਨਲਾਈਨ ਕਲਾਸਾਂ ਲੱਗ ਜਾਂਦੀਆਂ ਬੱਚੇ ਦੀ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਪੰਜਾਬ ਵਿੱਚ ਕਾਫੀ ਚੀਜ਼ਾਂ ਵੱਧ ਗਈਆਂ ਹਨ ਸਥਿਤੀ ਸਿੱਖਿਆ ਦੀ ਸਥਿਤੀ ਬਹੁਤ ਵੱਧ ਗਈ ਹੈ ਨਿਊ ਟੈਕਨੋਲੋਜੀ ਆ ਗਈਆਂ ਨੇ ਜਿਨ੍ਹਾਂ ਨਾਲ ਬੱਚਿਆਂ ਨੂੰ ਪੜ੍ਹਾਈ ਵਿੱਚ ਨੁਕਸਾਨ ਨਹੀਂ ਹੁੰਦਾ ਅਤੇ ਬੱਚੇ ਆਪਣਾ ਨਵੀਂ ਨਵੀਂ ਟੈਕਨੋਲੋਜੀ ਦੇ ਥਰੂ ਨਵੀਂ ਨਵੀਆਂ ਚੀਜ਼ਾਂ ਸਿੱਖਦੇ ਹਨ ਅੱਜ ਤਾਂ

ਨਾਲ ਬੱਚੇ ਅੱਜ ਕੱਲ੍ਹ ਨਹੀਂ ਇੰਨਾ ਸਿੱਖਦੇ ਜਿੰਨਾ ਕਿ ਪ੍ਰੈਕਟੀਕਲ ਕਰਕੇ ਸਿੱਖਦੇ ਹਨ ਅਤੇ ਨਵੀਆਂ ਨਵੀਆਂ ਟੈਕਨੋਲੋਜੀਆਂ ਸਕੂਲਾਂ ਵਿੱਚ ਲੱਗ ਗਈਆਂ ਹਨ ਜਿਹਦੇ ਨਾਲ ਉਹ ਪ੍ਰੈਕਟੀਕਲ ਕਰ ਸਕਣ ਤਾਂ ਉਹਨਾਂ ਨੂੰ ਕਾਫੀ ਸਿੱਖਿਆ ਮਤਲਬ ਹੈ ਮਤਲਬ ਮਦਦ ਮਿਲਦੀ ਆ ਨੌਲੇਜ ਮਿਲਦੀ ਆ ਪੜ੍ਹਾਈ ਕਰਨ 'ਚ ਅਤੇ ਅੱਜ ਕੱਲ੍ਹ ਤਾਂ ਵੈਸੇ ਹੀ ਕਿੰਨੀਆਂ ਐਪਸ ਵੀ ਆ ਗਈਆਂ ਹਨ ਜਿਹਨਾਂ ਦੇ ਥਰੂ ਬੱਚੇ ਪੜ੍ਹ ਸਕਦੇ ਹਨ ਜਿੱਦਾਂ ਕਿ ਯੂਟਿਊਬ ਹੋਵੇ ਹਨ ਜਿਹਦੇ ਨਾਲ ਬੱਚੇ ਪੜ੍ਹ ਸਕਣ ਈਵਨ ਕਿ ਤੁਸੀਂ ਦੂਰ ਬੈਠੇ ਵੀ ਉਹ ਚੀਜ਼ ਸਿੱਖ ਸਕਦੇ ਹੋ ਜੋ ਚੀਜ਼ ਤੁਸੀਂ ਇੱਥੇ ਨਹੀਂ ਸਿੱਖ ਸਕਦੇ ਵਿਦਆਊਟ ਪੇਅ ਕੀਤੇ

ਵਿਦਆਊਟ ਪੇਅ ਕੀਤੇ ਅਤੇ ਤੁਸੀਂ ਕਿੰਨੀਆਂ ਚੀਜ਼ਾਂ ਇੰਨੀਆਂ ਅੱਜ ਕੱਲ੍ਹ ਯੂਟਿਊਬ ਤੋਂ ਸਿੱਖ ਲੈਂਦੇ ਹੋ ਅਤੇ ਤੁਹਾਡੀ ਕਿੰਨੀ ਮਦਦ ਮਿਲਦੀ ਆ ਪੜ੍ਹਨ ਵਾਲੇ ਕਿੰਨੀ ਮਦਦ ਮਿਲਦੀ ਆ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਤੇ ਕਿੰਨੇ ਹੈਲਪਫੁੱਲ ਹੋ ਗਈਆਂ ਵਾਂ ਚੀਜ਼ਾਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਪੰਜਾਬ ਵਿੱਚ ਵੀ ਕਾਫੀ ਇਹ ਚੀਜ਼ਾਂ ਆ ਗਈਆਂ ਵਾ ਹੁਣ ਨਾ ਬੱਚੇ ਬੱਚਿਆਂ ਨੂੰ ਬੜੀ ਮਦਦ ਮਿਲਦੀ ਹੈ ਇਹ ਸਭ ਚੀਜ਼ਾਂ ਨਾਲ